ਹਾਂਜੀ ਭਾਅ ਜੀ ਕਿਵੇਂ ਹੋ ਹਾਂਜੀ ਹਾਂਜੀ ਦੱਸੋ ਚਾ ਅੱਛਾ ਅੱਛਾ ਹਾਂਜੀ ਹਾਂਜੀ ਹੁਣ ਜਿਹੜੀ ਚੀਜ਼ ਨੂੰ ਵੀ ਆਪਾਂ ਆਪਣਾ ਬਚੂ ਗਾ ਹਾਂਜੀ ਹਾਂਜੀ ਅਤੇ ਹਾਂਜੀ ਹਾਂਜੀ ਲੁਧਿਆਣਾ ਤੋਂ ਕੀ ਕਹਿੰਦੇ ਆ ਆਪਣਾ ਸਾਈਕਲ ਦਾ ਹੱਬ ਹੀ ਹੈਗਾ ਇੱਥੇ ਤਾਂ ਸਾਈਕਲ ਦੀ ਬਹੁਤ ਸਾਰੀ ਫੈਕਟਰੀਜ਼ ਹੈਗੀਆਂ ਨੇ ਇੱਥੇ ਤਾਂ ਸਾਈਕਲ ਕੰਮ ਹੀ ਹੁੰਦਾ ਹਾਂਜੀ

ਓ ਅੱਛਾ ਕੋਈ ਗੱਲ ਨਹੀਂ ਇੱਥੇ ਤਾਂ ਬਹੁਤ ਸਾਰੇ ਫੈਕਟਰੀਜ਼ ਹੈਗੀਆਂ ਨੇ ਹਾਂਜੀ ਹਾਂਜੀ ਹਾਂਜੀ ਲੁਧਿਆਣਾ ਤਾਂ ਹੱਬ ਹੈਗਾ ਤੁਸੀਂ ਸਰਚ ਕਰਕੇ ਦੇਖਿਓ ਕਦੇ ਗੂਗਲ 'ਤੇ ਹਾਂਜੀ ਅਤੇ ਉੱਦਾਂ ਵੀ ਅਸੀਂ ਪੁਰਾਣੇ ਰੈਜੀਡੈਂਸ ਹੈਗੇ ਹਾਂ ਇੱਥੇ ਸਾਨੂੰ ਪਤਾ ਹੀ ਆ ਚੀਜ਼ਾਂ ਬਾਰੇ ਮੇਰੇ ਦੋਸਤ ਦੀ ਵੀ ਇੱਕ ਫੈਕਟਰੀ ਹੈਗੀ ਆ ਇੱਥੇ ਸਾਹਨੇਵਾਲ ਵਾਲੀ ਸਾਈਡ ਹਾਂਜੀ ਬਹੁਤ ਸਾਰੀ ਫੈਕਟਰੀਜ਼ ਹੈਗੀਆਂ ਜੀ ਓਗੀ ਬਾਈਸਾਈਕਲ ਹੋ ਗਈ ਹੋ ਗਿਆ ਹੀਰੋ ਹੋ ਗਿਆ ਅਪਲਮ ਹੋ ਗਿਆ ਬਹੁਤ ਸਾਰੇ ਹੈਗੇ ਆ ਹਾਂ ਡੁਗਰੀ ਵਾਲੀ ਸਾਈਡ ਵੀ ਅਤੇ ਇੱਥੇ ਵਿਸ਼ਕਰਮਾ ਚੌਕ ਵਾਲੀ ਸਾਈਡ ਹਾਂਜੀ ਹਾਂਜੀ ਹਾਂਜੀ ਤੁਸੀਂ ਵਧੀਆ ਕੀਤਾ ਮੈਨੂੰ ਕਾਲ ਕੀਤੀ ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ ਹਾਂਜੀ ਹਾਂਜੀ ਲਿੱਤੀ ਸੀਗੀ ਦੋ ਤਿੰਨ ਸਾਲ ਪਹਿਲਾਂ ਹੀ ਲਿੱਤੀ ਸੀ ਹਾਂਜੀ ਡੁਗਰੀ ਵਾਲੀ ਸਾਈਡ ਤੋਂ ਹੀ ਲਿੱਤੀ ਸੀਗੀ ਏਵਨ ਸਾਈਕਲ ਸਰ ਇਹ ਤਾਂ ਆਪਣੀ ਬਿਨਾਂ ਗੇਅਰ ਵਾਲੀ ਸੀਗੀ ਅਤੇ ਸ਼ੋਕਰ ਤਾਂ ਲੱਗਿਆ ਹੋਈ ਸੀਗੀ ਟਾਇਰ ਟੂਰ ਤਾਂ ਵਧੀਆ ਸੀਗੇ ਇਸ ਲਈ ਆਪਾਂ ਨੂੰ ਪਈ ਸੀ ਅੱਠ ਹਜ਼ਾਰ ਦੀ ਹਾਂਜੀ ਤੁਸੀਂ ਕਿਹੜੀ ਲੈਣੀ ਹੈ ਉਹ ਤਾਂ ਸਟਾਰਟਿੰਗ ਹੈ ਨਾ ਸਟਾਰਟਿੰਗ ਆ ਦੋ ਤਿੰਨ ਚਾਰ ਤੋਂ ਸਟਾਰਟਿੰਗ ਹੋ ਜਾਂਦੀ ਹੈ ਜਿੰਨੀ ਮਰਜ਼ੀ ਲਓ ਇੱ ਲੱਖ ਦੋ ਲੱਖ ਤੱਕ ਵੀ ਲਓ ਤਾਹੀਂ ਫੋਨ ਕੀਤਾ ਇੱਦਾਂ ਦੀਆਂ ਸਾਈਕਲ ਵੀ ਹੈਗੀਆਂ ਨੇ ਕਿ ਮਹਿੰਗੀ ਮਹਿੰਗੀ ਸਾਈਕਲ ਸਸਤੇ ਸਸਤੇ ਸਾਈਕਲ ਸਾਰੇ ਬ ਬਣਦੀਆਂ ਨੇ ਇੱਥੇ

ਲੈਣੀ ਕਦੋਂ ਆ ਇਹ ਤੁਸੀਂ ਦੇਖੋ ਅਲੱਗ ਅਲੱਗ ਜਗ੍ਹਾ 'ਤੇ ਅਲੱਗ ਅਲੱਗ ਹੈਗੀਆਂ ਨੇ ਫੈਕਟਰੀਜ਼ ਹੈ ਨਾ ਠੀਕ ਹੈ ਅਤੇ ਤੁਸੀਂ ਦੱਸੋ ਕਿੱਧਰੋਂ ਲੈਣੀ ਆ ਆਪਣੇ ਇੱਧਰੋਂ ਡੁਗਰੀ ਵਾਲੀ ਸਾਈਡ ਤੋਂ ਹਾਂਜੀ ਕਿੰਨ ਹਾਂਜੀ ਹਾਂਜੀ ਦੋ ਤਿੰਨ ਫੈਕਟਰੀ ਟਰਾਈ ਕਰ ਲਾਂਗੇ ਵਾਲੇ ਕੋਲ ਚਲ ਜਾਂਗੇ ਇਹ ਆਪਣਾ ਹੀਰੋ ਅਤੇ ਆਪਣਾ ਜਗਦੰਬੇ ਵਾਲੀ ਸਾਈਡ ਤੋਂ ਦੇਖ ਲਾਂਗੇ ਹਾਂਜੀ ਹਾਂਜੀ ਹਾਂਜੀ ਕੰਪੇਅਰ ਕਰ ਲਾਂਗੇ ਨਾ ਸਾਰੀ ਫੈਕਟਰੀਜ਼ ਨੂੰ ਹਾਂਜੀ ਹਾਂਜੀ ਅੱਛਾ ਅੱਛਾ ਕੋਈ ਗੱਲ ਨਹੀਂ ਵੀਰ ਜੀ ਹਾਂਜੀ ਹਾਂਜੀ ਕੱਲ੍ਹ ਸੰਡੇ ਆ ਕੱਲ੍ਹ ਕੱਲ੍ਹ ਚੱਲ ਪਾਂਗੇ ਆਪਾਂ ਬਾਰਾਂ ਇੱਕ ਵਜੇ ਤੱਕ ਆ ਠੀਕ ਠੀਕ ਹੈ ਓਕੇ